ਸਾਡੀ ਨੌਜਵਾਨ ਪੀੜ੍ਹੀ ਸੱਭਿਆਚਾਰਕ ਰੀਤਾਂ ਦੀ ਸਖਤੀ ਨਾਲ ਪਾਲਣਾ ਨਹੀਂ ਕਰ ਰਹੀ ਹੈ ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ 'ਤੇ ਬਹੁਤ ਹੀ ਜ਼ਿਆਦਾ ਢਿੱਲ ਪੈ ਰਹੀ ਹੈ ਇਸ ਦੀ ਪਕੜ ਲਈ ਸਾਨੂੰ ਕਈ ਸਾਰੇ ਠੋਸ ਕਦਮ ਚੁੱਕਣੇ ਚਾਹੀਦੇ ਹਨ ਸਾਡੀ ਨੌਜਵਾਨ ਪੀੜ੍ਹੀ ਸੱਭਿਆਚਾਰ ਰੀਤਾਂ ਦੀ ਪਾਲਣਾ ਨਹੀਂ ਕਰ ਰਹੀ ਹੈ ਕਿਉਂਕਿ ਅੱਜ ਕੱਲ੍ਹ ਸਾਡੀ ਪੀੜ੍ਹੀ ਜ਼ਿਆਦਾਤਰ ਟੈਕਨਾਲੋਜੀ ਦੀ ਵਰਤੋਂ ਕਰਦੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਪਰ ਸਾਨੂੰ ਲੱਗਦਾ ਹੈ ਕਿ ਜੋ ਸਾਡੀਆਂ ਪੀੜ੍ਹੀਆਂ ਹਨ ਉਹ ਸੱਭਿਆਚਾਰਕ ਰੀਤਾਂ ਘਰ ਅਤੇ ਆਪਣੇ ਪਰਿਵਾਰ ਤੋਂ ਹੀ ਸਿੱਖਦੀਆਂ ਹਨ ਸਾਨੂੰ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਦੇ ਨਾਲ ਹੀ ਸੰਬੰਧ ਰੱਖਦਾ ਹੈ ਜਿਸ ਘਰ ਵਿੱਚ ਜ਼ਿਆਦਾ ਰੀਤਾਂ ਅਤੇ ਸੱਭਿਆਚਾਰ ਦੀ ਪਾਲਣਾ ਹੁੰਦੀ ਹੈ ਉੱਥੇ ਬੱਚੇ ਵੀ ਆਪਣੇ ਆਪ ਹੀ ਪਾਲਣਾ ਕਰਨ ਲੱਗ ਪੈਣਗੇ ਸਾਨੂੰ ਪਹਿਲਾਂ ਆਪਣੇ ਘਰਾਂ ਵਿੱਚ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਘਰਾਂ ਵਿੱਚ ਹੀ ਜਾਗਰੂਕ ਹੋਣਾ ਪਵੇਗਾ ਤਾਂ ਜੋ ਸਾਡੇ ਬੱਚਿਆਂ ਨੂੰ ਵੀ ਪਤਾ ਚੱਲੇ ਸੱਭਿਆਚਾਰਕ ਰੀਤਾਂ ਬਾਰੇ ਇਸ ਲਈ ਸਾਡੇ ਸੱਭਿਆਚਾਰਕ ਕਦਰਾਂ ਕੀਮਤਾਂ 'ਤੇ ਢਿੱਲੀ ਅਸੀਂ ਆਪ ਹੀ ਪਾ ਰਹੇ ਹਾਂ ਅਤੇ ਉਸ ਦੀ ਪਕੜ ਲਈ ਸਾਨੂੰ ਆਪਣੇ ਪਰਿਵਾਰ ਅਤੇ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਨੀ ਪਵੇਗੀ